ਹੈਲ ਹੈਲੋ ਹਾਂਜੀ ਤੁਸੀਂ ਫੈਂਸੀ ਕਲੋਥ ਹਾਊਸ ਤੋਂ ਬੋਲਦੇ ਪਏ ਹੋ ਹਾਂਜੀ ਮੈਂ ਨਾ ਤੁਹਾਡੇ ਕੋਲੋਂ ਬੱਚਿਆਂ ਦੇ ਕੱਪੜੇ ਲੈ ਕੇ ਗਈ ਸੀ ਮੈਂ ਪਰਸੋਂ ਆਈ ਸੀਗੀ ਤੁਹਾਡੇ ਕੋਲ ਪਰਸੋਂ ਸਾਢੇ ਕੁ ਗਿਆਰਾਂ ਬਾਰ੍ਹਾਂ ਵਜੇ ਦਾ ਟਾਈਮ ਸੀਗਾ ਹਾਂਜੀ ਅਤੇ ਤੁਸੀਂ ਹਾਂਜੀ ਹਾਂਜੀ ਮੈਂ ਅਤੇ ਮੇਰੇ ਹਸਬੈਂਡ ਆਏ ਸੀਗੇ ਅਤੇ ਮੈਂ ਇੱਕ ਤਾਂ ਵੱਡੇ ਬੱਚੇ ਦੇ ਕੱਪੜੇ ਲੈ ਕੇ ਗਈ ਸੀ ਦਸ ਕੁ ਸਾਲ ਦਾ ਬੇਟਾ ਮੇਰਾ ਉਹਦੀ ਮੈਂ ਪੈਂਟ ਸ਼ਰਟ ਲੈ ਕੇ ਗਈ ਸੀਗੀ ਅਤੇ ਇੱਕ ਜੈਕਟ ਲੈ ਕੇ ਗਈ ਸੀਗੀ ਹਾਂ ਅਤੇ ਛੋਟੇ ਬੱਚੇ ਦੇ ਬੇਟੇ ਦੇ ਵੀ ਕੱਪੜੇ ਲੈ ਕੇ ਗਈ ਸੀ ਉਹਦਾ ਵੀ ਇਹ ਉਹਦੇ ਸਵੈਟਰ ਸੀਗੇ ਦੋ ਅਤੇ ਇੱਕ ਪੂਰਾ ਜੈਕਟ ਸੀਗੀ ਅਤੇ ਜੀਨ ਸੀਗੀ ਨਾਲ ਹਾਂਜੀ ਪਰ ਉਹ ਅਤੇ ਫਿਰ ਉਹ ਮੈਂ ਨਾ ਉਹਦੇ ਪਾ ਕੇ ਦੇਖਿਆ ਉੱਥੇ ਉਹਨੇ ਕਿਉਂਕਿ ਰੋਣ ਲੱਗ ਗਿਆ ਸੀ ਅਤੇ ਮੈਨੂੰ ਪਾ ਕੇ ਨਹੀਂ ਦੇਖ ਦੇਖਣ ਦਿੱਤਾ ਛੋਟੇ ਬੱਚੇ ਨੇ ਅਤੇ ਉਹ ਸੂਟ ਦਾ ਵੀ ਨਾ ਥੋੜ੍ਹਾ ਜਿਹਾ ਮੈਨੂੰ ਘਰੇ ਆ ਕਿ ਕਲਰ ਅਤੇ ਅੰਦਰ ਦੇ ਪ ਪਾਸੇ ਨੂੰ ਥੋੜ੍ਹਾ ਡਿਫੈਕਟਡ ਲੱਗਦਾ ਬਈ ਖ਼ਰਾਬ ਹੈ ਥੋੜ੍ਹਾ ਜਿਹਾ ਧਾਗੇ ਉੱਤਰੇ ਹੋਏ ਜਿਵੇਂ ਹਾਂਜੀ ਹਾਂਜੀ ਉਹ ਉਹ ਨਾ ਜਿਵੇਂ ਪਤਾ ਨਹੀਂ ਹੁਣ ਮੈਂ ਤਾਂ ਜਿਵੇਂ ਉੱਥੇ ਚੈੱਕ ਨਹੀਂ ਕੀਤਾ ਅੰਦਰਲੇ ਪਾਸੇ ਉੱਤੋਂ ਬਸ ਬਾਹਰੋਂ ਹੀ ਟਰਾਈ ਕੀਤਾ ਅਤੇ ਬਾਹਰੋਂ ਹੀ ਪਾ ਕੇ ਵੇਖ ਲਿਆ ਅਤੇ ਅੰਦਰ ਬਈ ਜਦੋਂ ਮੈਂ ਘਰੇ ਜਾ ਕੇ ਵੇਖਿਆ ਅਤੇ ਸਾਈਡ ਬਦਲੀ ਉਹਦੀ ਵੀ ਚੈੱਕ ਕਰਦੇ ਪੈਏ ਸੀ ਅਤੇ ਅੰਦਰੋਂ ਸਾਰਾ ਜਿਵੇਂ ਧਾਗੇ ਨਿਕਲੇ ਹੋਏ ਆ ਬੜੇ

ਹਾਂ ਅਤੇ ਉਹ ਵੱਡੇ ਬੱਚੇ ਦੇ ਵੀ ਥੋੜ੍ਹੀ ਜੀਨ ਕਰਵਾ ਕਰਨੀ ਆ ਚੇਂਜ ਉਹ ਉਹਦੀ ਜੀਨ ਦੇ ਵੀ ਉਪਰੋਂ ਟਾਈਟ ਉਹ ਆਈ ਆ ਉਹਨੂੰ ਥੋੜ੍ਹੀ ਜਿਹੀ ਨਹੀਂ ਨਹੀਂ ਫਿਰ ਮੈਂ ਲੈ ਕੇ ਵੀ ਤਾਂ ਤੁਹਾਡੇ ਤੋਂ ਗਈ ਆ ਨਾ ਕਿੰਨਾ ਸਮਾਨ ਤਾਂ ਲੈ ਕੇ ਗਈ ਹੈ ਅਤੇ ਹੁਣ ਤੁਸੀਂ ਬਦਲ ਤਾਂ ਸਕਦੇ ਹੀ ਹੋ ਨਹੀਂ ਫਿਰ ਜੇ ਤੁਸੀਂ ਹੁਣ ਬਦਲੋਗੇ ਨਹੀਂ ਤਾਂ ਸਾਡੇ ਤਾਂ ਕਿਸੇ ਕੰਮ ਦੇ ਨਹੀਂ ਫਿਰ ਉਹ ਕੱਪੜੇ ਹੁਣ ਉਹਨੂੰ ਟਾਏ ਉਸ ਤੋਂ ਟਾਈਟ ਹੈਗੀ ਕਮਰ ਤੋਂ ਅਤੇ ਫਿਰ ਮੈਂ ਉਸ ਜੀਨ ਦਾ ਹੁਣ ਕੀ ਕਰਾਂਗੀ ਜਦੋਂ ਤੁਸੀਂ ਨਹੀਂ ਬਦਲੋਗੇ ਤਾਂ ਕਿਉਂਕਿ ਬੱਚਾ ਨਹੀਂ ਨਹੀਂ ਜੀ ਅਸੀਂ ਨਹੀਂ ਨਹੀਂ ਨਹੀਂ ਨਹੀਂ ਅਸੀਂ ਬਦਲਣੇ ਤਾਂ ਨਹੀਂ ਹੈਗੇ ਉਹ ਪੈਸੇ ਤਾਂ ਨਹੀਂ ਸਾਨੂੰ ਚਾਹੀਦੇ ਕਿ ਬਦਲ ਕੇ ਸਾਨੂੰ ਸਿਰਫ ਕੱਪੜੇ ਬਦਲ ਦਿਓ ਕਿਉਂਕਿ ਉਹ ਹੁਣ ਉਦੋਂ ਪਾ ਕੇ ਨਹੀਂ ਦੇਖੀ ਬੱਚਾ ਨਾਲ ਨਹੀਂ ਸੀਗਾ ਅਤੇ ਉਹਨੇ ਪਾ ਕੇ ਫਿਰ ਘਰੇ ਆ ਕੇ ਜਦੋਂ ਪਾ ਕੇ ਦੇਖੀ ਤਾਂ ਉੱਤੋਂ ਟਾਈਟ ਸੀਗੀ ਤਾਂ ਫਿਰ ਉਹ ਦਾ ਫਾਇਦਾ ਨਹੀਂ ਨਾ ਹਾਂਜੀ ਹਾਂਜੀ ਅਸੀਂ ਕੱਲ੍ਹ ਮੈਂ ਤਾਂ ਕੱਲ੍ਹ ਆ ਜਾਵਾਂਗੀ ਜੇ ਨਾ ਮੇਰੇ ਤੋਂ ਆਇਆ ਗਿਆ ਤਾਂ ਮੇਰੇ ਹਸਬੈਂਡ ਆ ਜਾਣਗੇ ਅਤੇ ਤੁਸੀਂ ਉਹਨਾਂ ਨੂੰ ਇੱਕ ਤਾਂ ਜੀਨ ਦਾ ਨੰਬਰ ਵ ਵੱਡਾ ਇੱਕ ਇੱਕ ਨੰਬਰ ਵੱਡਾ ਕਰਕੇ ਦੇ ਦਿਓ ਜੇ ਅਤੇ ਇੱਕ ਉਹਦਾ ਜਿਹੜਾ ਡਿਫੈਕਟਡ ਪੀਸ ਹੈਗਾ ਉਹ ਵੀ ਚੇਂਜ ਕਰਕੇ ਦੇ ਦਿਓ ਜੇ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ